ਹੈਲੋ ਹਾਂਜੀ ਸਰ ਤੁਸੀਂ ਓਲਾ ਟੈਕਸੀ ਤੋਂ ਬੋਲ ਰਹੇ ਹੋਗੇ ਸਰ ਮੈਂ ਇੱਕ ਕੈ ਇੱਕ ਟੈਕਸੀ ਬੁੱਕ ਕਰਨੀ ਹੈਗੀ ਆ ਅਸੀਂ ਅੰਮ੍ਰਿਤਸਰ ਜਾਣਾ ਹੈਗਾ ਘੁੰਮਣ ਵਾਸਤੇ ਅਤੇ ਅਸੀਂ ਦਸ ਪੰਦਰਾਂ ਜਣੇ ਹੈਗੇ ਐਗੇ ਅਤੇ ਸਾਨੂੰ ਮਤਲਬ ਗੱਡੀ ਵਧੀਆ ਚਾਹੀਦੀ ਹੈਗੀ ਆ ਪੂਰੀ ਕੰਫਰਟੇਬਲ ਅਤੇ ਸਾਨੂੰ ਉਸ ਦੇ ਲਈ ਕਿੰਨੀ ਪੇ ਕਿੰਨੇ ਪੈਸੇ ਦੇਣੇ ਪੈਣਗੇ ਅਤੇ ਉਹਦੇ ਲਈ ਅ ਮਤਲਬ ਸਾਨੂੰ ਐਵੇਂ ਦਾ ਚਾਹੀਦਾ ਹੈਗਾ ਗਾ ਕਿ ਨਾਲ ਬੱਚੇ ਹੋਣਗੇ ਫੈਮਲੀ ਹੋਣਗੇ ਹੋਵੇਗੀ ਜੇ ਅਗਰ ਅਸੀਂ ਕਿਤੇ ਵੀ ਸਟੋਪ ਕਰਨਾ ਹੈਗਾ ਰੁਕਣਾ ਹੈਗਾ ਤਾਂ ਸਾਨੂੰ ਕੋਈ ਦਿੱਕਤ ਨਾ ਆਵੇ ਅਤੇ ਸਾਨੂੰ ਤੁਸੀਂ ਇੱਥੋਂ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਜਾਣ ਦਾ ਵਿਦ ਅ ਰਾਤ ਨੂੰ ਰਹਿਣਾ ਅਸੀਂ ਉੱਥੇ ਹੋਟਲ ਦੇ ਰੁਕਣਾ ਹੈ ਨਾ ਉਹ ਸਾਰਾ ਕੁਝ ਤੁਸੀਂ ਆਪਣਾ ਸਾਰਾ ਵੀ ਸਾਨੂੰ ਬਜਟ ਬਣਾ ਕੇ ਸਾਨੂੰ ਦੱਸ ਦਿਓ ਸਾਨੂੰ ਕਿੰਨਾ ਖਰਚਾ ਆਵੇਗਾ ਬਟ ਸਾਨੂੰ ਜਿਹੜਾ ਤੁਸੀਂ ਨਾਲ ਭੇਜੋ ਭੇਜੋਂਗੇ ਡਰਾਈਵਰ ਕੋਈ ਵੀ ਜਿਹੜਾ ਹੋਵੇਗਾ ਨਾ ਉਹ ਸਾਨੂੰ ਵਧੀਆ ਚਾਹੀਦਾ ਹੈਗਾ ਮੀਨਜ਼ ਕਿ ਬੱਚੇ ਹੋਣਗੇ ਨਾਲ ਫੈਮਲੀ ਹੋਵੇਗੀ ਤਾਂ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ ਕਿਉਂਕਿ ਉਹਦੇ ਵਿੱਚ ਛੋਟੇ ਬੱਚੇ ਦਾ ਤੁਹਾਨੂੰ ਪਤਾ ਹੈਗਾ ਕਿ ਸਾਨੂੰ ਮਤਲਬ ਕਿਤੇ ਵੀ ਰੁਕਣਾ ਵੀ ਪੈ ਸਕਦਾ ਕੋਈ ਬੱਚੇ ਨੂੰ ਪ੍ਰੋਬਲਮ ਹੋ ਸਕਦੀ ਹੈਗੀ ਹੈ ਅਤੇ ਇਹਦੇ ਲਈ ਸਾਨੂੰ ਕੋਈ ਵੀ ਐਵੇਂ ਨਾ ਹੋਵੇ ਵੀ ਮੀਨਜ਼ ਕੋਈ ਰੁਕਿਆ ਨਾ ਜਾਵੇ ਜਾਂ ਮੀਨਜ਼ ਤੁਸੀਂ ਆਪਣਾ ਟਾਈਮ ਉਹ ਕਰੋ ਤੁਸੀਂ ਕਹੋਂਗੇ ਵੀ ਇੰਨੇ ਤੋਂ ਇੰਨੇ ਟਾਈਮ ਤੱਕ ਹੈ ਹੀ ਅਸੀਂ ਵਾਪਸ ਮੁੜਨਾ ਹੈਗਾ ਅਤੇ ਸਾਨੂੰ ਉੱਥੇ ਰਾਤ ਵੀ ਲੱਗ ਸਕਦੀ ਹੈਗੀ ਸਾਨੂੰ ਤੁਸੀਂ ਆਪਣਾ ਸਾਰਾ ਜਿਹੜਾ ਹੈਗਾ ਬਣਾ ਕੇ ਦੱਸ ਦਿਓ ਤੁਸੀਂ ਕਿੰਨਾ ਖਰਚਾ ਸਾਨੂੰ ਪਵੇਗਾ ਅਤੇ ਕਿੰਨਾ ਸਾਨੂੰ ਪਹਿਲਾਂ ਐਡਵਾਂਸ ਮਤਲਬ ਪਹਿਲਾਂ ਦੇਣਾ ਪਵੇਗਾ ਅਤੇ ਕਿੰਨਾ ਸਾਨੂੰ ਬਾਅਦ 'ਚ ਦੇਣਾ ਪਵੇਗਾ ਉਹ ਸਾਰਾ ਤੁਸੀਂ ਸਾਨੂੰ ਆਪਣਾ ਬਣਾ ਕੇ ਸਾਰਾ ਸ਼ਡਿਊਲ ਭੇਜ ਦਿਓ ਸਰ